ਬਾਈਕਰ ਦੁਨੀਆ ਦੇ ਕੋਨੇ ਕੋਨੇ ਵਿੱਚ ਘੁੰਮਦੇ ਹਨ ਅਤੇ ਕਈ ਮੀਲਾਂ ਦਾ ਸਫਰ ਤੈਅ ਕਰਦੇ ਹਨ ਉਹ ਉੱਥੇ ਜਾ ਕੇ ਫਿਰ ਉਹਨਾਂ ਦਾ ਰਹਿਣਾ ਸਹਿਣਾ ਸਿੱਖਦੇ ਹਨ ਅਤੇ ਖਾਣਾ ਪੀਣਾ ਖ ਦੇਖਦੇ ਸ ਖਾਂਦੇ ਅਤੇ ਸਿੱਖਦੇ ਹਨ ਅਤੇ ਉਹਨਾਂ ਦੇ ਸੱਭਿਆਚਾਰ ਬਾਰੇ ਗੱਲਾਂ ਕਰਦੇ ਹਨ ਅਤੇ ਆਪਣੇ ਸੱਭਿਆਚਾਰ ਬਾਰੇ ਉਹਨਾਂ ਨੂੰ ਦੱਸਦੇ ਹਨ ਅਤੇ ਉਹਨਾਂ ਦੇ ਸ ਕ ਆਪਣਾ ਸੱਭਿਆਚਾਰ ਨਾਲ਼ ਮੇਲ ਕਰਵਾਉਂਦੇ ਹਨ ਅਤੇ ਉਹਨਾਂ ਦੀਆਂ ਕਹਾਣੀਆਂ ਸੱਭਿਆਚਾਰ ਬਾਰੇ ਸੁਣਦੇ ਹਨ ਅਤੇ ਆਪਣੇ ਸੱਭਿਆਚਾਰ ਬਾਰੇ ਉਹਨਾਂ ਨੂੰ ਦੱਸਦੇ ਹਨ ਜਿਸ ਨਾਲ਼ ਉਹਨਾਂ ਨੂੰ ਉਹਨਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇਸ ਨਾਲ਼ ਸੱਭਿਆਚਾਰ ਦਾ ਮੇਲ ਜੋਲ ਵੱਧਦਾ ਹੈ